ਹੈਲੋ ਸਤਿ ਸ਼੍ਰੀ ਅਕਾਲ ਜੀ ਐਮਾਜ਼ੋਨ ਕਸਟਮਰ ਕੇਅਰ ਤੋਂ ਗੱਲ ਕਰ ਰਹੇ ਹੋ ਜੀ ਹਾਂਜੀ ਸਰ ਸਰ ਅਸੀਂ ਨਾ ਤੁਹਾਡੇ ਕੋਲੋਂ ਬੱਚਿਆਂ ਦੀਆਂ ਬੁੱਕਸ ਪਰਚੇਜ ਕੀਤੀਆਂ ਸੀ ਸੈਵਨ ਕਲਾਸ ਐਂਡ ਸੈਕਿੰਡ ਕਲਾਸ ਦੀਆਂ ਸਰ ਜਿਹੜੀਆਂ ਸਰ ਤੁਹਾਡੇ ਵੱਲੋਂ ਅਸੀਂ ਬੁੱਕਸ ਪਰਚੇਜ ਕੀਤੀਆਂ ਨੇ ਇੱਕ ਤਾਂ ਉਹਨਾਂ ਦੀ ਜਿਹੜੀ ਪੈਕਿੰਗ ਹੈ ਸਾਨੂੰ ਬਹੁਤ ਅੱਛੀ ਲੱਗੀ ਕਿ ਉਹ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਸਾਨੂੰ ਪੈਕ ਕਰਕੇ ਦਿੱਤੀਆਂ ਸੀ ਅਤੇ ਦੂਸਰਾ ਸਰ ਜਿਹੜੀ ਉਹ ਵਿੱਚੋਂ ਅਸੀਂ ਜਦੋਂ ਬੁੱਕਸ ਕੱਢੀਆਂ ਤਾਂ ਉਹ ਬੁੱਕਸ ਦੀ ਮਤਲਬ ਜਿਲਦ ਆ ਨਾ ਜੋ ਬਹੁਤ ਹੀ ਅੱਛੇ ਤਰੀਕੇ ਦੀ ਲੱਗੀ ਹੋਈ ਹੈ ਕਵਰ ਜਿਹੜਾ ਉਹ ਬਹੁਤ ਵਧੀਆ ਢੰਗ ਨਾਲ ਹੋਇਆ ਕੀਤਾ ਗਿਆ ਤੁਹਾਡੇ ਵੱਲੋਂ ਦੂਸਰਾ ਸਾਨੂੰ ਸਭ ਤੋਂ ਵੱਧ ਇਹ ਖੁਸ਼ੀ ਹੈ ਕਿ ਜਿਹੜੀਆਂ ਬੁੱਕਸ ਸੀਗੀਆਂ ਸਾਨੂੰ ਸਮੇਂ ਸਿਰ ਪ੍ਰਾਪਤ ਹੋ ਗਈਆਂ ਅਤੇ ਸਾ ਇਸ ਲਈ ਸਾਨੂੰ ਤੁਹਾਡੇ ਤੋਂ ਡਿਸਕਾਊਂਟ ਵੀ ਅੱਛਾ ਮਿਲਿਆ ਕਿ ਤੁਸੀਂ ਸਾਨੂੰ ਅਸੀਂ ਬਾਕੀ ਸ਼ੋਪ 'ਤੇ ਪਤਾ ਕੀਤਾ ਸੀ ਜਿੱਦਾਂ ਸਾਨੂੰ ਬਹੁਤ ਮਤਲਬ ਕਿ ਕੋਈ ਟੈੱਨ ਪਰਸੈਂਟ ਹੀ ਦੇ ਰਿਹਾ ਸੀ ਕੋਈ ਟਵੰਟੀ ਪਰਸੈਂਟ ਦੇ ਰਿਹਾ ਸੀ ਤੁਹਾਡੇ ਵੱਲੋਂ ਸਾਨੂੰ ਜਿੱਦਾਂ ਥਰਟੀ ਪਰਸੈਂਟ ਡਿਸਕਾਊਂਟ ਮਿਲ ਗਿਆ ਅਤੇ ਬੱਚੇ ਬੁੱਕਸ ਨੂੰ ਦੇਖ ਇੰਨਾ ਖੁਸ਼ ਹੋਏ ਕਿ ਬ ਉਹਨਾਂ ਦੇ ਜਿਹੜੇ ਕਵਰ ਸੀ ਬਹੁਤ ਹੀ ਕਲਰਫੁੱਲ ਸੀਗੇ ਬਹੁਤ ਹੀ ਪਿਆਰੇ ਸੀਗੇ ਕਿ ਜਦੋਂ ਜਿਹੜੀ ਸਾਡੀ ਅੱਖਾਂ ਦੀ ਖਿੱਚ ਸੀਗੀ ਅਤੇ ਮਨ ਦੀ ਜਿਹੜੀ ਖੁਸ਼ੀ ਆ ਉਹਨਾਂ ਨੂੰ ਦੇਖ ਕੇ ਮਤਲਬ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਸਾਨੂੰ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਸਰ ਕਿ ਨੈਕਸਟ ਟਾਈਮ ਅਸੀਂ ਜੇ ਅਸੀਂ ਬੁੱਕਸ ਪਰਚੇਜ ਕਰਨੀਆਂ ਨੇ ਤਾਂ ਅਸੀਂ ਤੁਹਾਡੇ ਤੋਂ ਹੀ ਪਰਚੇਜ ਕਰਨਾ ਕਰਾਂਗੇ ਅਤੇ ਹੋਰ ਦੂਸਰਿਆਂ ਨੂੰ ਵੀ ਅਸੀਂ ਮੋਟੀਵੇਟ ਕਰਾਂਗੇ ਕਿ ਤੁਸੀਂ ਐਮਾਜ਼ੋਨ ਤੋਂ ਹੀ ਬੁੱਕਸ ਪਰਚੇਜ ਕਰੋ